ਹਾਂਜੀ ਸਾਡੇ ਖੇਤਰ ਦੀਆਂ ਕੁੱਝ ਖੇਡ ਦੀਆਂ ਟੀਮਾਂ ਹਨ ਜੋ ਕਿ ਰਾਸ਼ਟਰੀ ਪੱਧਰ 'ਤੇ ਆਪਣੀ ਨੁਮਾਇੰਦਗੀ ਕਰਦੀਆਂ ਹਨ ਅਤੇ ਜੇਕਰ ਸਾਡੇ ਨਜ਼ਦੀਕ ਦੇ ਸ਼ਹਿਰ ਮੋਹਾਲੀ ਦੀ ਗੱਲ ਕਰੀ ਕੀਤੀ ਜਾਵੇ ਤਾਂ ਮੋਹਾਲੀ ਸ਼ਹਿਰ ਦੀਆਂ ਬਹੁਤ ਸਾਰੀਆਂ ਟੀਮਾਂ ਦੇ ਹਰ ਲਗਭਗ ਹਰ ਇੱਕ ਗੇਮ ਵਿੱਚ ਟੀਮਾਂ ਹਨ ਜੋ ਰਾਸ਼ਟਰੀ ਪੱਧਰ 'ਤੇ ਖੇਡ ਰਹੀਆਂ ਹਨ ਵਾਲੀਵਾਲ ਵਿੱਚ ਵੀ ਰਾਸ਼ਟਰੀ ਪੱਧਰ 'ਤੇ ਸਾਡੇ ਮੋਹਾਲੀ ਸ਼ਹਿਰ ਦੀ ਟੀਮ ਬਹੁਤ ਹੀ ਜਿਆਦਾ ਮਸ਼ਹੂਰ ਹੈ ਅਤੇ ਇਹ ਟੀਮ ਹਰ ਵਾਰ ਕੋਈ ਨਾ ਕੋਈ ਇਨਾਮ ਵੀ ਜਿੱਤ ਕੇ ਲਿਆਉਂਦੀ ਹੈ